ਯੋਗਾ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ ਜਿੱਥੇ ਸਿਰਫ਼ ਜਿੰਮ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਯੋਗ ਨਾਲ ਸਾਡੇ ਸਰੀਰ ਦੇ ਨਾਲ ਨਾਲ ਸਾਡੀ ਸਿਹਤ ਵੀ ਬਣੀ ਰਹਿੰਦੀ ਹੈ ਜੇਕਰ ਮਾਹਿਰਾਂ ਦੀ ਗੱਲ ਮੰਨੀਏ ਤਾਂ ਯੋਗਾ ਸਿਰਫ਼ ਸਰੀਰਕ ਕਸਰਤ ਨਹੀਂ ਬਲਕਿ ਅਜਿਹਾ ਅਭਿਆਸ ਹੈ ਜੋ ਸਾਡੇ ਸਰੀਰ ਦੇ ਮਨ ਨੂੰ ਦੋਵੇਂ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਯੋਗ ਗੁਰੂਆਂ ਨੇ ਯੋਗ ਨੂੰ ਮਨੁੱਖ ਦੇ ਮਨ 'ਚ ਉੱਠਣ ਵਾਲੀਆਂ ਨਾਕਰਾਤਮਕ ਸੋਚਾਂ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਦਾ ਸਾਧਨ ਦੱਸਿਆ ਹੈ ਜਿਹੜਾ ਵਿਅਕਤੀ ਆਪਣੇ ਕੰਮ ਕਾਜ ਵਿੱਚ ਜ਼ਿਆਦਾ ਵਿਅਸਤ ਹੋਣ ਕਰਕੇ ਆਪਣੀ ਸਿਹਤ ਨਾਲ ਖਿਲਵਾੜ ਕਰਦਾ ਹੈ ਉਸ ਲਈ ਯੋਗ ਬਹੁਤ ਜ਼ਿਆਦਾ ਵਧੀਆ